ਮੈਂ ਸੰਗੀਤ ਵਿੱਚ ਉਸ ਹਿਸਾਬ ਵਿੱਚ ਬਹੁਤ ਵੱਡੇ ਸਮਾਗਮ ਵਿੱਚ ਗਿਆ ਹਾਂ ਇਹਦੇ ਵਿੱਚ ਸਭ ਤੋਂ ਜ਼ਿਆਦੇ ਮੈਨੂੰ ਸਮਾਗਮ ਵਧੀਆ ਲੱਗਿਆ ਹੁਸ਼ਿਆਰਪੁਰ ਵਿੱਚ ਬੱਬੂ ਮਾਨ ਦਾ ਸ਼ੋਅ ਲੱਗਿਆ ਕਿਉਂਕਿ ਇੱਥੋਂ ਮੈਂ ਤੋਂ ਸਤ ਸੱਠ ਸੱਤਰ ਕਿਲੋਮੀਟਰ ਦੂਰ ਸੀ ਅਤੇ ਮੇਰੇ ਯਾਰਾਂ ਦੋਸਤਾਂ ਨੇ ਮਿਲ ਕੇ ਮਿਲ ਕੇ ਅਸੀਂ ਗਏ ਅਤੇ ਰ ਰਸਤੇ ਦੋ ਢਾਈ ਘੰਟੇ ਦਾ ਰਸਤਾ ਸੀ ਅਸੀਂ ਉੱਥੇ ਪਹੁੰਚੇ ਸਮਾਗਮ ਵਿੱਚ ਬਹੁਤ ਜ਼ਿਆਦੇ ਪੰਡਾਲ ਭਰਿਆ ਸੀ ਬਹੁਤ ਜ਼ਿਆਦਾ ਭੀੜ ਸੀ ਅਤੇ ਬਹੁਤ ਜ਼ਿਆਦੇ ਵਧੀਆ ਬ ਬੱਬੂ ਗਾਣੇ ਗਾ ਰਿਹਾ ਸੀ ਅਤੇ ਬਹੁਤ ਵਧੀਆ ਲੱਗਿਆ ਅਤੇ ਆਲ਼ੇ ਦੁਆਲ਼ੇ ਬਹੁਤ ਵਧੀਆ ਜਾਣੀ ਕਿ ਉਸ ਤੋਂ ਬਾਅਦ ਹੋਰ ਸਮਾਗਮ ਬਹੁਤ ਹੋਏ ਆ ਜਾਣੀ ਕਿ ਨਵਾਂਸ਼ਹਿਰ ਜਲੰਧਰ ਉੱਥੇ ਵੀ ਅਸੀਂ ਸਮਾਗਮਾਂ ਨੂੰ ਗਏ ਸਮਾਗਮਾਂ 'ਚ ਬਹੁਤ ਵਧੀਆ ਗਾਣੇ ਸਾਨੂੰ ਸੁਣਨ ਨੂੰ ਮਿਲੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਵਧੀਆ ਯਾਨੀ ਕਿ ਗਾਣੇ ਹੋਏ ਉੱਥੇ ਹ ਜਿਵੇਂ ਕਿ ਅਰਜਨ ਢਿੱਲੋਂ ਮੂਸੇ ਆਲੇ ਦੇ ਵੀ ਅਸੀਂ ਬਹੁਤ ਜ਼ਿਆਦੇ ਸ਼ੋਆਂ 'ਤੇ ਗਏ ਅਸੀਂ ਉੱਥੇ ਉਹਨਾਂ ਦੇ ਗਾਣੇ ਸੁਣੇ ਸਾਨੂੰ ਬਹੁਤ ਵਧੀਆ ਲੱਗਿਆ ਯਾਨੀ ਕਿ ਸੰਗੀਤ ਬਹੁਤ ਵਧੀਆ ਹੈ ਸਾਡੇ ਲਈ ਬਹੁਤ ਵਧੀਆ ਉਤਸ਼ਾਹ ਹੈ ਸੰਗੀਤ ਇੱਕ ਲ ਜ਼ਿੰਦਗੀ ਵਿੱਚ ਵੱਖਰਾ ਹੀ ਆਨੰਦ ਦਿੰਦਾ ਹੈ ਅਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਅਸੀਂ ਬਹੁਤ ਸਮਾਗਮਾਂ ਵਿੱਚ ਗਏ ਅਸੀਂ ਬਹੁਤ ਆਨੰਦ ਲਿਆ ਜੀ